ਮੈਂ ਸੂਰਜ ਗ੍ਰਹਿਣ ਦੇਖਿਆ ਹੈ ਸੂਰਜ ਗ੍ਰਹਿਣ ਦੇ ਅੰਦਰ ਸੂਰਜ ਅਤੇ ਧਰਤੀ ਦੇ ਵਿੱਚ ਚੰਦਰਮਾ ਆ ਜਾਂਦਾ ਹੈ ਜਿਹਦੇ ਕਰਕੇ ਸੂਰਜ ਦੀ ਰੌਸ਼ਨੀ ਬਿਲਕੁਲ ਮੱਧਮ ਪੈ ਜਾਂਦੀ ਹੈ ਰੋਸ਼ਨੀ ਮੱਧਮ ਹੋਣ ਕਰਕੇ ਜੋ ਵੀ ਚਿੜੀਆਂ ਹਨ ਉਹ ਆਪਣੇ ਘੌਂਸਲੇ ਵੱਲ ਵਾਪਸ ਚਲੀ ਜਾਂਦੀਆਂ ਹਨ ਇਹ ਸੋਚ ਕੇ ਵੀ ਸ਼ਾਮ ਪੈ ਗਈ ਹੈ ਸੂਰਜ ਗ੍ਰਹਿਣ ਨੂੰ ਕਦੇ ਵੀ ਸਿੱਧਾ ਨਹੀਂ ਦੇਖਣਾ ਚਾਹੀਦਾ ਜਿਹਦੇ ਕਰਕੇ ਲੋਕ ਅਕਸਰ ਸੂਰਜ ਗ੍ਰਹਿਣ ਨੂੰ ਵੈਲਡਿੰਗ ਗਲਾਸ ਦੇ ਨਾਲ਼ ਦੇਖਦੇ ਹਨ